ਹਾਂਜੀ ਮੈਨੂੰ ਲੱਗਦਾ ਹੈ ਕਿ ਸਾਡੇ ਹੋਰ ਗ੍ਰਹਿਆਂ 'ਤੇ ਵੀ ਜੀਵਨ ਹੈ ਕਿਉਂਕਿ ਅੱਜ ਤੋਂ ਦੋ ਤਿੰਨ ਮਹੀਨੇ ਪਹਿਲਾਂ ਬਹੁਤ ਜ਼ਿਆਦਾ ਖਬਰਾਂ ਆਈਆਂ ਸੀ ਕਿ ਕਈ ਇੱਕ ਪਲੈਨਟ ਵੀਨਸ ਵਿੱਚ ਆਕਸੀਜਨ ਵੀ ਮਿਲ ਗਈ ਇਸ ਕਾਰਨ ਮੈਨੂੰ ਇਹ ਦਿਲਚਸਪ ਸਮਾਨਤਾ ਵਿੱਚ ਮੈਂ ਬੋਲਣਾ ਚਾਹੁੰਦਾ ਹਾਂ ਕਿ ਕਈ ਪਲੈਨਟਾਂ ਵਿੱਚ ਕਈ ਗ੍ਰਹਿਆਂ ਵਿੱਚ ਇੱਥੇ ਪਾਣੀ ਅਤੇ ਬਹੁਤ ਰਹਿਣ ਵਾਲੀਆਂ ਚੀਜ਼ਾਂ ਵੀ ਮਿਲ ਸਕਦੀਆਂ ਹਨ ਜਿਹਨਾਂ ਕਾਰਨ ਸਾਡੇ ਪੰਜਾਬ ਸਾਡੇ ਦੇਸ਼ ਨੂੰ ਇੱਥੇ ਗ੍ਰਹਿ ਪੂਰੇ ਗ੍ਰਹਿਆਂ ਵਿੱਚ ਰਹਿ ਸਕਿਆ ਰਿਹਾ ਜਾ ਸਕਦਾ ਹੈ ਇਹ ਬਹੁਤ ਤੁਕ ਬਹੁਤ ਜ਼ਿਆਦਾ ਸਹੀ ਮਿਲਦੀ ਜੁਲਦੀ ਜਾ ਰਹੀ ਹੈ ਇਸ ਲਈ ਇੱਦਾਂ ਹੀ ਇੱਕ ਗ੍ਰਹਿ ਮਾਰਸ ਵਿੱਚ ਬਹੁਤ ਇੱਥੇ ਦੇ ਸਾਡੇ ਬਹੁਤ ਵਿਗਿਆਨ ਵਿਗਿਆਨਿਕਾਂ ਨੇ ਉੱਥੇ ਜਾਣ ਲਈ ਬਹੁਤ ਜ਼ਿਆਦਾ ਸਪੇਸਸ਼ਿਪ ਭੇਜੇ ਉੱਥੇ ਚੈੱਕ ਘਰ ਲੱਭੇ ਜਾ ਰਹੇ ਹਨ ਕਿ ਕਿਹੜੀ ਕਿਹੜੀ ਜਗ੍ਹਾ ਉੱਥੇ ਰਹਿਣ ਲਈ ਹੈਗੀਆਂ ਹੈ ਮਨੁੱਖ ਮਨੁੱਖੀ ਜੀਵਨ ਹੈ ਵਸਦਾ ਹੈ ਜਿੱਥੇ ਪਾਣੀ ਹੈ ਅਤੇ ਉੱਥੇ ਖਾਣ ਆਕਸੀਜਨ ਹੈ ਜਿੱਥੇ ਆਪਣਾ ਮਨੁੱਖੀ ਵੀ ਜੀਵਨ ਵਸਾਇਆ ਜਾ ਸਕੇ ਇੱਦਾਂ ਦੇ ਬਹੁਤ ਸਾਰੇ ਉਹ ਗ੍ਰਹਿ ਲੱਭੇ ਜਾ ਰਹੇ ਹਨ ਉਹ ਹਰ ਸਾਲ ਸਾਡਾ ਆਪਣੇ ਗ੍ਰਹਿ 'ਤੇ ਲੋਕ ਸਾਡੇ ਦੇਸ਼ ਇੱਥੇ ਤੋਂ ਬਹੁਤ ਜ਼ਿਆਦਾ ਮਿਸਾਇਲ ਉੱਥੇ ਤੋਂ ਬਹੁਤ ਜ਼ਿਆਦਾ ਸੈਟੇਲਾਈਟਾਂ ਦੇ ਰਾਹੀਂ ਉੱਥੇ ਤੋਂ ਚੈਕ ਲੱਭਿਆ ਜਾ ਰਿਹਾ ਹੈ ਸਾਡੇ ਸਾਇਟਿਸਟ ਬਹੁਤ ਜ਼ਿਆਦਾ ਖੋਜਬੀਨ ਕਰਦੇ ਹਨ ਹਰੇਕ ਸਾਲ ਬਹੁਤ ਜ਼ਿਆਦਾ ਪੈਸਾ ਖਰਚ ਕੀਤਾ ਜਾਂਦਾ ਹੈ ਇਹੀ ਦੇਖਣ ਲਈ ਕਿ ਸਾਡੇ ਦੇਸ਼ ਲਈ ਹੋਰ ਜ਼ਿਆਦਾ ਕੋਈ ਰਹਿਣ ਨਹੀਂ ਯੋਗ ਦ ਕੋਈ ਗ੍ਰਹਿ ਮਿਲ ਸਕੇ ਜਿਸ ਨਾਲ ਬਾਈ ਕਦੇ ਕੋਈ ਦੁਰਘਟਨਾ ਨਾ ਹੋ ਜਾਵੇ ਤਾਂ ਆਪਣਾ ਦੀ ਆਪਣੇ ਆਪਣਾ ਗ੍ਰਹਿ ਛੱਡ ਕੇ ਦੂਜੇ ਗ੍ਰਹਿ ਵਿੱਚ ਜਾ ਕੇ ਰਿਹਾ ਜਾ ਸਕੇ ਇਸ ਲਈ ਬਹੁਤ ਜ਼ਿਆਦਾ ਤੋਂ ਪੱਧਰ 'ਤੇ ਅ ਸਾਡੇ ਗ੍ਰਹਿ ਦੇ ਲੋਕ ਬਾਹਰਲੇ ਗ੍ਰਹਿਆਂ ਵਿੱਚ ਮਨੁੱਖੀ ਜੀਵਨ ਦੀ ਭਾਲ ਕਰ ਰਹੇ ਹਨ ਕਿ ਕੋਈ ਔਰ ਇੱਦਾਂ ਦੇ ਸਾਡੇ ਹੀ ਵਾਂਗੂ ਕੋਈ ਮਨੁੱਖੀ ਲੋਕ ਤਾਂ ਨਹੀਂ ਰਹਿ ਰਹੇ ਕਿਤੇ ਹੋਰ ਜੀਵਨ ਤਾਂ ਨਹੀਂ ਵੱਸ ਰਿਹਾ ਇਸ ਲਈ ਉਹ ਬਹੁਤ ਜ਼ਿਆਦਾ ਤੌਰ ਕੋਸ਼ਿਸ਼ਾਂ ਕਰਦੇ ਹਨ